ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਹਰਪ੍ਰੀਤ ਬੋਲ ਰਹੀ ਹਾਂ ਮੈਂ ਪਟਿਆਲੇ ਤੋਂ ਕੈਬ ਬੁੱਕ ਕਰਵਾਉਣੀ ਸੀ ਅਠਾਰਾਂ ਨੰਬਰ ਗਲੀ ਤੋਂ ਰੋਪੜ ਤੱਕ ਦੀ ਅਤੇ ਮੈਂ ਸਰਹੰਦ ਤੋਂ ਆਪਣੇ ਮੰਮੀ ਅਤੇ ਆਪਣੇ ਭਰਾ ਨੂੰ ਵੀ ਲੈਣਾ ਹੈ ਨਾਲ਼ ਮੈਨੂੰ ਕਰਾਇਆ ਦੱਸ ਦਿਉ ਇਹਦਾ ਪੂਰਾ ਕਿੰਨਾ ਹੋਊਗਾ ਅਤੇ ਦੋ ਬੈਗ ਵੀ ਸੀ ਨਾਲ਼ ਔਰ ਟਾਈਮ ਵੀ ਦੱਸ ਦਿਉ ਮੈਨੂੰ ਕਿੰਨਾ ਕੁ ਲੱਗੂਗਾ ਉੱਥੇ ਜਾਣ ਨੂੰ